ਮੇਰਾ ਜਨਮ ਪੰਜਾਬ ਰਾਜ ਦਾ ਹੈ ਅਤੇ ਮੇਰਾ ਜਨਮ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਹੈ ਅਤੇ ਮੇਰੀ ਮਾਤ ਭਾਸ਼ਾ ਪੰਜਾਬੀ ਹੈ ਇਸ ਲਈ ਮੈਨੂੰ ਜਿਹੜੀ ਮੇਰੀ ਮਾਤ ਭਾਸ਼ਾ ਸਿੱਖਣ ਦੀ ਲੋੜ ਨਹੀਂ ਪਈ ਅਤੇ ਮੈਂ ਆਪਣੇ ਆਪ ਹੀ ਪੰਜਾਬੀ ਬੋਲਣ ਲੱਗ ਪਿਆ ਕਿਉਂਕਿ ਜੋ ਬੰਦੇ ਦੀ ਮਾਤ ਭਾਸ਼ਾ ਹੁੰਦੀ ਹੈ ਉਹ ਬੰਦਾ ਆਪਣੇ ਆਪ ਬੋਲਣੀ ਸਿੱਖ ਜਾਂਦਾ ਹੈ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਹ ਬਹੁਤ ਚੰਗੀ ਹੈ ਪੰਜਾਬੀ ਮਾਂ ਬੋਲੀ ਦਾ ਸਿਹਰਾ ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਜੀ ਦਿੱਤਾ ਗਿਆ ਪੰਜਾਬੀ ਵਰਨਮਾਲਾ ਦੀ ਕਾਢ ਗੁਰੂ ਅੰਗਦ ਦੇਵ ਜੀ ਨੇ ਕੀਤੀ ਅਤੇ ਜਿਹੜੀ ਪੰਜਾਬੀ ਵਰਨਮਾਲਾ ਇਹਨੇ ਤਰਤੀਬ ਅਨੁਸਾਰ ਰੱਖਿਆ ਪੰਜਾਬੀ ਵਰਨਵਾਲਾ ਜਦੋਂ ਸ਼ੁਰੂ 'ਚ ਹੁੰਦੀ ਸੀਗੀ ਉਦੋਂ ਇਹ ਪੈਂਤੀ ਅੱਖਰੀ ਸੀ ਬਾਅਦ ਵਿੱਚ ਫਾਰਸੀ ਦੇ ਪ੍ਰਭਾਵ ਕਾਰਨ ਪੰਜਾਬੀ ਵਰਨਮਾਲਾ ਵਿੱਚ ਨਵੀਆਂ ਛੇ ਧੁਨੀਆਂ ਆਈਆਂ ਜਦੋਂ ਕਿਤੇ ਗਾੜਾ ਉਚਾਰਨ ਕਰਨਾ ਹੋਵੇ ਉਦੋਂ ਇਹਨਾਂ ਛੇ ਧੁਨੀਆਂ ਦੀ ਵਰਤੋ ਕੀਤੀ ਜਾਂਦੀ ਹੈ ਅਤੇ ਇਹ ਨਵੀਆਂ ਧੁਨੀਆਂ ਫਾਰਸੀ ਦੇ ਪ੍ਰਭਾਵ ਕਾਰਨ ਆਈਆਂ